ਪੰਜਾਬ ਵਿੱਚ ਟੈਕਨੋਲੋਜੀ ਖੇਤਰ ਵਿੱਚ ਕਰੀਅਰ ਦੇ ਕਈ ਵਧੀਆ ਮੌਕੇ ਹਨ ਕਿਉਂਕਿ ਆਈ ਟੀ ਅਤੇ ਡਿਜ਼ੀਟਲ ਉਦਯੋਗ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ ਸਭ ਤੋਂ ਪਹਿਲਾਂ ਸੋਫਟਵੇਅਰ ਡਿਪਲੋਮੈਟ ਦੇ ਖੇਤਰ ਵਿੱਚ ਫਰੰਟ ਐਂਡ ਡਿਵਲਪਰ ਜੂਨੀਅਰ ਸਾਫਟਵੇਅਰ ਇੰਜੀਨੀਅਰ ਅਤੇ ਫੁੱਲ ਸਟੈਕ ਡਿਵਲੈਪਰ ਵਰਗੀਆਂ ਨੌਕਰੀਆਂ ਬਹੁਤ ਮੰਗ ਵਿੱਚ ਹਨ ਇਹਨਾਂ ਪਦਵੀਆਂ ਲਈ ਜਾਵਾ ਸਕ੍ਰਿਪਟ ਪਾਈਥਨ ਰਿਐਕਟ ਅਤੇ ਨੋਡ ਡੋਟ ਜੇ ਐਸ ਵਰਗੀ ਟਕਨੀਕੀ ਹੁਨਰਾਂ ਦੀ ਲੋੜ ਹੁੰਦੀ ਹੈ ਤਨਖਾਹ ਦੀ ਗੱਲ ਕਰੀਏ ਤਾਂ ਸ਼ੁਰੂਆਤ ਤਿੰਨ ਛੇ ਤਿੰਨ ਤੋਂ ਲੈ ਕੇ ਛੇ ਲੱਖ ਰੁਪਏ ਦੇ ਵਿੱਚ ਘਰ ਪ੍ਰਤੀ ਸਾਲ ਦੀ ਤਨਖਾਹ ਮਿਲ ਸਕਦੀ ਹੈ ਜੋ ਅਨੁਭਵ ਅਨੁਭਵ ਵਧਣ ਨਾਲ ਕਾਫ਼ੀ ਵੱਧ ਵੀ ਵੱਧ ਵੀ ਜਾਂਦੀ ਹੈ ਇੱਦਾਂ ਦੀ ਕੋਈ ਗੱਲ ਹੈ ਨਹੀਂ ਸ਼ੁਰੂਆਤ 'ਚ ਘੱਟ ਹੋਤੀ ਹੈ ਬਾਅਦ 'ਚ ਵੱਧ ਜਾਂਦੀ ਹੈ ਤਰੱਕੀ ਦੇ ਨਾਲ ਦੂਜੀ ਅਗਰ ਗੱਲ ਕਰੀਏ ਤਾਂ ਆਈ ਟੀ ਸਪੋਰਟ ਅਤੇ ਨੈਟਵਰਕ ਐਡਮਿਨਿਸਟ੍ਰੇਸ਼ਨ ਵਿੱਚ ਡੈਸਕਟਾਪ ਸਪੋਰਟ ਇੰਜੀਨੀਅਰ ਇੰਜੀਨੀਅਰ ਸਿਸਟਮ ਐਡਮਿਨਿਸਟਰੇਟਰ ਅਤੇ ਕਲਾਊਡ ਇੰਜੀਨੀਅਰ ਵਰਗੀ ਨੌਕਰੀਆਂ ਉਪਲਬੱਧ ਹਨ ਇਹਨਾਂ ਲਈ ਲੀਨਿਕਸ ਨੈਟਵਰਕਿੰਗ ਕਲਾਊਡ ਕੰਪਿਊਟਿੰਗ ਏ ਡਬਲਿਊ ਐਸ ਐਸਓਰ ਅਤੇ ਸਾਈਬਰ ਸਿਕਿਰਟੀ ਵਰਗੇ ਹੁਨਰਾਂ ਦੀ ਲੋੜ ਹੁੰਦੀ ਹੈ ਇਹ ਖੇਤਰ ਪੰਜਾਬ ਵਿੱਚ ਆਈ ਟੀ ਕੰਪਨੀਆਂ ਬੈਂਕ ਅਤੇ ਹੋਰ ਉਦਯੋਗ ਵਿੱਚ ਮਜ਼ਬੂਤ ਸਥਿਤੀ ਬਣਾਈ ਹੋਈ ਹੈ ਇਸ ਤੋਂ ਇਲਾਵਾ ਡਾਟਾ ਸਾਇੰਸ ਆਰਟੀਫਿਸ਼ਅਲ ਇੰਟੈਲੀਜੈਂਸ ਡਿਜੀਟਲ ਮਾਰਕੀਟ ਅਤੇ ਯੂ ਆਈ ਯੂ ਐਕਸ ਡਿਜਾਈਨ ਵਰਗੇ ਖੇਤਰ ਵੀ ਵੱਧ ਰਹੇ ਹਨ ਸਟਾਰਟਅਪਸ ਐਮ ਐਨ ਸੀਜ ਅਤੇ ਆਈ ਟੀ ਪਾਰਕਸ ਜਿਵੇਂ ਕਿ ਮੁਹਾਲੀ ਆਈ ਡੀ ਪਾਕ ਵਿੱਚ ਇਹਨਾਂ ਦੀਆਂ ਇਹਨਾਂ ਲਈ ਵਧੀਆ ਸੰਭਾਵਨਾ ਹਨ ਪੰਜਾਬ ਸਕਿਲ ਡਿਵਲਪਮੈਂਟ ਮਿਸ਼ਨ ਅਤੇ ਹੋਰ ਸਰਕਾਰੀ ਸਕੀਮਾਂ ਯੂਵਕਾਂ ਨੂੰ ਨਵੀਆਂ ਤਕਨੀਕਾਂ ਵਿੱਚ ਟ੍ਰੇਨਿੰਗ ਦਿੰਦੀਆਂ ਹਨ ਜਿਹਨਾਂ ਜਿਸ ਨਾਲ ਨੌਕਰੀ ਦੀ ਸੰਭਾਵਨਾ ਹੋਰ ਵੱਧਦੀ ਹੈ ਇਸ ਲਈ ਜੋ ਵੀ ਵਿਅਕਤੀ ਟੈਕਨੋਲੋਜੀ ਵਿੱਚ ਕਰੀਅਰ ਬਣਾਉਣਾ ਚਾਹੁੰਦਾ ਹੈ ਉਸ ਲਈ ਪੰਜਾਬ ਵਿੱਚ ਬੇਹਤਰੀਨ ਮੌਕੇ ਮੌਜ਼ੂਦ ਹਨ